ਹਾਂਜੀ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਅਤੇ ਕਈ ਵਾਰ ਜਦੋਂ ਬਿਜਲੀ ਦੇ ਕੱਟ ਲੱਗ ਜਾਂਦੇ ਹਨ ਤਾਂ ਬਹੁਤ ਹੀ ਪ੍ਰਭਾਵਿਤ ਹੁੰਦੇ ਹਾਂ ਇਸ ਕਰਕੇ ਅਸੀਂ ਦੀਵਾ ਮੋਮਬੱਤੀ ਵਗੈਰਾ ਉਹਦੇ ਨਾਲ਼ ਕੰਮ ਸਾਰ ਲੈਂਦੇ ਹਾਂ ਅਤੇ ਖਾਣਾ ਵਗੈਰਾ ਬਣਾ ਲੈਂਦੇ ਹਾਂ ਕਈ ਲੋਕਾਂ ਨੇ ਇੰਨਵੈਟਰ ਵੀ ਲਗਵਾਏ ਹੋਏ ਹਨ ਜਿਨ੍ਹਾਂ ਦਾ ਫਾਇਦਾ ਲੈਟ ਜਾਣ 'ਤੇ ਹੁੰਦਾ ਹੈ ਅਤੇ ਪੱਖੇ ਵਗੈਰਾ ਟਿਊਬਾਂ ਵਗੈਰਾ ਅਤੇ ਬੱਲਬ ਚੱਲ ਪੈਂਦੇ ਹਨ ਇੰਨਵੈਟਰ ਦਾ ਵੀ ਬਹੁਤ ਫਾਈਦਾ ਹੈ ਇੱਥੇ ਲੋਕਾਂ ਨੇ ਕਈ ਲੋਕਾਂ ਨੇ ਇੰਨਵੈਟਰ ਲਗਵਾਏ ਹੋਏ ਹਨ